ਹੈਲੋ ਗੁਰਜੀਤ ਕੌਰ ਬੋਲਦੇ ਜੀ ਤੁਸੀਂ ਸਾਨੂੰ ਤੁਹਾਡਾ ਨੰਬਰ ਦਿੱਤਾ ਸੀ ਜੀ ਕਿਸੇ ਨੇ ਸਾਨੂੰ ਕੰਮ ਵਾਸਤੇ ਘਰੇ ਲੋੜ ਐ ਬੱਚੇ ਸਾਂਭਣ ਵਾਸਤੇ ਹਾਂਜੀ ਠੀਕ ਤੁਸੀਂ ਸਾਂਭ ਸਕਦੇ ਓਂ ਹਾਂਜੀ ਬੱਚੇ ਜੀ ਛੋਟੇ ਛੋਟੇ ਨੇ ਗੇ ਇੱਕ ਪੰਜ ਕ ਸਾਲ ਦਾ ਗਾ ਇੱਕ ਤਿੰਨ ਕ ਸਾਲ ਦਾ ਇੱਕ ਸੱਤ ਛੇ ਸੱਤ ਸਾਲ ਦਾ ਏ ਹਾਂ ਹਾਂਜੀ ਹਾਂਜੀ ਖਾਣਾ ਅਸੀਂ ਬਣਾ ਕੇ ਰੱਖ ਕੇ ਜਾਇਆ ਕਰਾਂਗੇ ਜੀ ਤੁਸੀਂ ਖਵਾਉਣਾ ਈ ਐਗਾ ਖਵਾਉਣਾ ਹਾਂ ਤੇ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਹਾਂਜੀ ਹਾਂ ਤੇ ਤੁਸੀਂ ਤਨਖਾਹ ਤਨਖੂਹ ਦਾ ਕਿਵੇਂ ਵੀ ਕੀ ਕੁਸ ਲਓਂਗੇ ਲਉਂਗੇ ਹਾਂਜੀ ਹਾਂਜੀ ਹਾਂ ਖਾਣਾ ਖਾਣਾ ਤਾਂ ਅਸੀਂ ਬਣਾ ਕੇ ਜਾਇਆ ਕਰਾਂਗੇ ਜੀ ਤੁਸੀਂ ਖਵਾਉਣਾ ਈ ਐ ਨੌਂ ਵਜੇ ਤੋਂ ਦ ਨੌਂ ਨੌਂ ਵਜੇ ਤੋਂ ਦੋ ਵਜੇ ਤੱਕ ਹਾਂਜੀ ਹਾਂ ਪੰਜ ਕ ਹਜਾਰ ਦੇ ਦਿਆਂਗੇ ਜੀ ਅੱਛਾ ਤੁਸੀਂ ਅੱਗੇ ਵੀ ਕਿਤੇ ਕੰਮ ਕੀਤਾ ਜੀ ਤੁਸੀਂ ਅੱਗੇ ਵੀ ਕੰਮ ਕੀਤਾ ਕਿਤੇ ਕਿੱਥੇ ਜੀ ਹਾਂਜੀ ਬਸ ਬੱਚਿਆਂ ਦਾ ਧਿਆਨ ਪੂਰਾ ਰੱਖਣਾ ਹਾਂਜੀ ਤੇ ਬਾਕੀ ਬਸ ਤਨਖਾਹ ਤਨਖਾਹ ਥੋਨੂੰ ਦੱਸ ਦਿੱਤੀ ਪੰਜ ਕ ਅੱਛਾ ਹਾਂਜੀ ਹਾਂਜੀ ਚਲੋ ਕੋਈ ਗੱਲ ਨੀ ਜੀ ਸੱਤ ਤੱਕ ਹਾਂਜੀ ਹਾਂਜੀ ਹਾਂਜੀ ਹਾਂ ਚਲੋ ਸੱਤ ਹਜਾਰ ਤੱਕ ਦੇ ਦਾਂਗੇ ਜੀ ਹਾਂ ਕੋਈ ਗੱਲ ਨੀ ਹਾਂਜੀ ਹਾਂ ਕੋਈ ਗੱਲ ਨੀ ਹਾਂਜੀ ਕੋਈ ਗੱਲ ਨੀ ਜੀ ਤੁਸੀਂ ਆ ਕੇ ਗੱਲ ਕਰਲੋ ਹਾਂ ਹਾਂ ਤੇ ਸੋਮਵਾਰ ਨੂੰ ਸੋਮਵਾਰ ਤੱਕ ਆਜਿਓ ਹਾਂ ਫੋਨ ਕਰਕੇ ਆਇਓ ਜੀ ਜਦੋਂ ਵੀ ਆਓਂਗੇ ਹਾਂਜੀ ਹਾਂ ਠੀਕ ਐ ਜੀ ਥੈਂਕਿਊ ਜੀ